ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬੱਚਾ ਹਾਂਜੀ ਹਾਂਜੀ ਹਾਂਜੀ ਬੱਚਾ ਪੁੱਛੋ ਵੈਸੇ ਬੱਚਾ ਇਸ ਵਾਰੀ ਤਾਂ ਮੈਂ ਵੀ ਦੇਖਿਆ ਕਿ ਇੱਥੇ ਕ ਕੈਂਪਸ 'ਚ ਕੰਪਨੀਜ਼ ਆਈਆਂ ਬਹੁਤ ਘੱਟ ਹੈ ਅਤੇ ਤੁਸੀਂ ਔਫਲਾਈਨ ਟਰਾਈ ਕਰਕੇ ਦੇਖੋ ਜੇ ਤੁਸੀਂ ਇਨ ਇੰਟਰਨਸ਼ਿਪ ਲਈ ਜਾਂ ਆਪਣੀ ਪਲੇਸਮੈਂਟ ਲਈ ਦੇਖਣਾ ਅਤੇ ਆਪਣਾ ਐਪਟੀਟਿਊ ਸਟਰੋਂਗ ਕਰੋ ਅਤੇ ਜੇ ਤੁਸੀਂ ਗੌਰਮੈਂਟ ਜੋਬ ਵਾਸਤੇ ਜਾਣਾ ਚਾਹੁੰਦੇ ਹੋ ਤਾਂ ਗੌਰਮੈਂਟ ਇਗਜ਼ਾਮਸ ਕਾਫ਼ੀ ਨਿਕਲ ਰਹੇ ਨੇ ਸੋ ਉਹਨੂੰ ਕਰੈਕ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਹਾਂਜੀ ਬੱਚਾ ਤੁਸੀਂ ਇੱਥੇ ਵੀ ਐੱਮ ਐੱਮ ਚੱਲ ਜਾਓ ਅਤੇ ਉਹ ਹੀ ਤੁਹਾਨੂੰ ਇੰਟਰਨਸ਼ਿਪ ਪ੍ਰੋਵਾਈਡ ਕਰ ਦੇਣਗੇ ਅਤੇ ਉਸ ਤੋਂ ਬਾਅਦ ਉਹ ਹੀ ਤੁਹਾਨੂੰ ਪਲੇਸ ਵੀ ਕਰ ਦੇਣਗੇ ਹਾਂ ਓਕੇ ਓਕੇ ਧੰਨਵਾਦ ਧੰਨਵਾਦ